ਜੇਕਰ ਪੇਂਡੂ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਗੱਲ ਕਰੀਏ ਆਪਾਂ ਬਾਂਦਰ ਕਿੱਲਾ ਕਬੱਡੀ ਕੁਸ਼ਤੀ ਬਰਫ਼ ਪਾਣੀ ਲੁਕਣ ਮੀਚੀ ਰੱਸਾ ਕੱਸੀ ਦੋੜਾਂ ਪਤੰਗ ਉਡਾਉਣਾ ਅਤੇ ਇਸਦੇ ਨਾਲ਼ ਮਿਲਦੀਆਂ ਜੁਲਦੀਆਂ ਹੋਰ ਵੀ ਕਈ ਪ੍ਰਕਾਰ ਦੀਆਂ ਗੇਮਾਂ ਹਨ ਅਤੇ ਜੇਕਰ ਆਪਾਂ ਨਾਲ਼ ਹੀ ਸ਼ਹਿਰਾਂ ਦੇ ਖੇਤਰਾਂ ਵਿੱਚ ਖੇਡਣ ਵਾਲ਼ੀਆਂ ਗੇਮਾਂ ਦਾ ਗੱਲ ਕਰੀਏ ਤਾਂ ਇਸਦੇ ਵਿੱਚ ਚੈੱਸ ਕ੍ਰਿਕਟ ਫੁੱਟਬਾਲ ਡਿਸਟਿਸ ਥਰੋ ਬੈਡਮਿੰਟਨ ਹੈਂਡਬਾਲ ਵਾਲੀਬਾਲ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਗੇਮਾਂ ਆ ਜਾਂਦੀਆਂ ਹਨ ਜਿਸ ਨੂੰ ਅਸੀਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਖੇਡਦੇ ਹਾਂ ਅਤੇ ਇਹ ਦੋਨੋਂ ਹੀ ਗੇਮਾਂ ਸਾਰੀਆਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਖੇਲੀਆਂ ਜਾਂਦੀਆਂ ਹਨ ਅਤੇ ਜੋ ਇਹਨਾਂ ਦੇ ਵਿੱਚ ਅੰਤਰ ਦਰਸਾਇਆ ਗਿਆ ਹੈ ਇਹਨਾਂ ਦੇ ਵਿੱਚ ਹੈ